ਘਰ ਰਹਿ ਕੇ ਅਸੀਂ ਲੋਕਡਾਊਨ ਦੇ ਵਿੱਚ ਬਹੁਤ ਚੀਜ਼ਾਂ ਘਰ ਵਿੱਚ ਪਕਾਉਣ ਪਕਾਈਆਂ ਸਿੱਖੀਆਂ ਜਿਵੇਂ ਕਿ ਆਲੂ ਟਿੱਕੀ ਹੋ ਗਿਆ ਗੋਲ ਗੱਪੇ ਹੋ ਗਏ ਫ੍ਰੈਂਚ ਫ੍ਰਾਈਜ਼ ਹੋ ਗਏ ਮੋਮੋਜ਼ ਹੋ ਗਏ ਸੈਨਵਿਚ ਹੋ ਗਿਆ ਪੀਣ ਲਈ ਵੀ ਅਸੀਂ ਬਹੁਤ ਚੀਜ਼ਾਂ ਜਿਵੇਂ ਕਿ ਮੈਂਗੋ ਸ਼ੇਕ ਹੋ ਗਏ ਬਨਾਨਾ ਸ਼ੇਕ ਹੋ ਗਏ ਇੱਦਾਂ ਦਾ ਮਟੀਰੀਅਲ ਵੀ ਅਸੀਂ ਬਣਾ ਕੇ ਖਾਦਾ ਅਤੇ ਬਹੁਤ ਕੁਛ ਸਿੱਖਿਆ ਘਰ ਵਿੱਚ ਸਬਜ਼ੀਆਂ ਵੀ ਸਿੱਖੀ ਸਿੱਖੀਆ ਬਣਾਉਣੀਆਂ ਕੋਈ ਰਾਜ਼ਮਾਹ ਹੋ ਗਿਆ ਮੋਮੋਜ਼ ਹੋ ਗਿਆ ਸੈਨਵਿਚ ਵਗੈਰਾ ਹੋ ਗਿਆ ਫਰੂਟ ਵਗੈਰਾ ਹੋ ਗਿਆ ਸੈਲਟ ਵਗੈਰਾ ਹੋ ਗਿਆ ਇੱਦਾਂ ਦਾ ਅਸੀਂ ਬਹੁਤ ਕੁਛ ਸਿੱਖਿਆ ਬਣਾਉਣਾ ਇਸ ਨਾਲ ਸਾਨੂੰ ਤਾਂ ਜੋ ਅਸੀਂ ਘਰ ਵਿੱਚ ਬੋਰਿੰਗਸ ਬੋ ਬੋਰਿੰਗ ਫੀਲ ਨਾ ਕਰੀਏ ਇਸ ਨਾਲ ਸਾਨੂੰ ਅੱਛਾ ਲੱਗਿਆ ਸਿਖ ਇਸ ਨਾਲ ਅਸੀਂ ਸਿੱਖ ਵੀ ਗਏ ਅਤੇ ਘਰ ਵਿੱਚ ਅਸੀਂ ਰਹਿ ਰਹਿ ਕੇ ਵੀ ਵਧੀਆ ਦਿਨ ਗੁਜ਼ਾਰ ਲਏ ਵਧੀਆ ਟੈਮ ਗੁਜ਼ਾਰ ਲਿਆ